ਰੋਪੜ ਸ਼ਹਿਰ ਦਾ ਵਾਤਰ ਵਾਤਾਵਰਣ ਬਹੁਤ ਹੀ ਸੋਹਣਾ ਅਤੇ ਵਿਲੱਖਣ ਹੈ ਇਹਦੇ ਵਿੱਚ ਪਹਾੜ ਵੀ ਆਉਂਦੇ ਹਨ ਇਹਦੇ ਵਿੱਚ ਸਤਲੁਜ ਦਰਿਆ ਵੀ ਆਉਂਦੀ ਹੈ ਇਹਦੇ ਵਿੱਚ ਇੱਕ ਭਾਖੜ੍ਹਾ ਨਦੀ ਵੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਜਿਹੜੇ ਧਰਤੀ ਉੱਤੇ ਜਿਹੜੇ ਪੇੜ੍ਹ ਪੌਦੇ ਹਨ ਜਿਹੜੇ ਜਿਹੜੀ ਜਾਨਵਰ ਜਿਹੜਾ ਵਾਤਾਵਰਣ ਹੈ ਉਹਨਾਂ ਦਾ ਉਹ ਵੀ ਬਹੁਤ ਸੋਹਣਾ ਹੈ ਅਤੇ ਜਿਹੜੀ ਪਹਿਲਕਦਮੀਆਂ ਲਈਆਂ ਗਈਆਂ ਨੇ ਜਿਵੇਂ ਕਿ ਅ ਡੀ ਸੀ ਔਫਿਸ ਵੱਲੋਂ ਸਤਲੁਜ ਨਹਿਰ ਦੇ ਸਤਲੁਜ ਦਰਿਆ ਦੇ ਵਿੱਚ ਜਦ ਕੂੜਾ ਕਰਕਟ ਫੈਕਟਰੀਆਂ ਦੇ ਦੁਆਰਾ ਸੁੱਟਿਆ ਜਾਂਦਾ ਸੀ ਤਾਂ ਉਨ੍ਹਾਂ ਉੱਤੇ ਪਹਿਲਕਦਮੀ ਲਈ ਗਈ ਉਹਨਾਂ ਨੂੰ ਰੋਕਿਆ ਗਿਆ ਸੜਕਾਂ ਉੱਤੇ ਜਿਹੜਾ ਕੂੜਾ ਕਰਕਟ ਲੋਕ ਸੁੱਟ ਦਿੰਦੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਪਹਿਲਕਦਮੀ ਲਈ ਗਈ ਉਸ ਤੋਂ ਬਾਅਦ ਨਹਿਰਾਂ ਦੇ ਵਿੱਚ ਜਿਹੜੇ ਲੋਕ ਜਲ ਪ੍ਰਵਾਹ ਕਰ ਦਿੰਦੇ ਨੇ ਬੇਫ਼ਾਲਤੂ ਦੀਆਂ ਚੀਜ਼ਾਂ ਉਹਨਾਂ ਨੂੰ ਰੋਕਣ ਦੀ ਵੀ ਪਹਿਲਕਦਮੀ ਲਈ ਗਈ ਇਹਨਾਂ ਸਾਰੀਆਂ ਚੀਜ਼ਾਂ ਨੇ ਰੋਪੜ ਦੇ ਵਾਤਾਵਰਣ ਨੂੰ ਬਹੁਤ ਵਧੀਆ ਅਤੇ ਬਹੁਤ ਸ਼ੁੱ ਸ਼ੁੱਧ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਕੋਰੋਨਾ ਕਾਲ ਦੇ ਵਿੱਚ ਵੀ ਜਿਹੜੀ ਪਲਿਊਸ਼ਨ ਦਾ ਜਿਹੜਾ ਘੱਟ ਜਾਣਾ ਹੈਏ ਉਹਨੇ ਰੋਪੜ ਦੇ ਵਾਤਾਵਰਣ ਨੂੰ ਬਹੁਤ ਹੀ ਵਧੀਆ ਕਰ ਦਿੱਤਾ ਹੈ